ਮੈਨੂੰ ਆਪਣੇ ਦੋਸਤਾਂ ਨਾਲ ਘੁੰਮਣਾ ਬਹੁਤ ਪਸੰਦ ਹੈ ਪਰ ਵਧੇਰੇ ਮੈਂ ਆਪਣੇ ਦੋਸਤ ਦਿਲਪ੍ਰੀਤ ਨਾਲ ਘੁੰਮਣਾ ਪਸੰਦ ਕਰਾਂਗਾ ਕਿਉਂਕਿ ਉਸ ਨੂੰ ਵੀ ਘੁੰਮਣ ਦਾ ਬਹੁਤ ਸ਼ੌਕ ਹੈ ਅਸੀਂ ਪਿਛਲੀ ਵਾਰ ਜਦੋਂ ਘੁੰਮਣ ਗਏ ਤਾਂ ਅਸੀਂ ਬਹੁਤ ਇੰਜੋਏ ਕੀਤਾ ਦਿਲਪ੍ਰੀਤ ਅਤੇ ਮੈਂ ਜਦੋਂ ਵੀ ਟਰੈਵਲ ਜਾਂ ਕਿਤੇ ਟ੍ਰਿਪ 'ਤੇ ਜਾਂਦੇ ਹਾਂ ਤਾਂ ਬਹੁਤ ਇੰਜੋਏ ਕਰਦੇ ਹਾਂ ਦਿਲਪ੍ਰੀਤ ਆਪਣੀ ਜ਼ਿੰਮੇਵਾਰੀ ਪੂਰੀ ਸਮਝਦਾ ਹੈ ਕਿਸੇ ਵੀ ਟਰੈਵਲ ਅਤੇ ਜਾਂ ਟਰਿਪ ਉੱਪਰ ਘੁੰਮਣ ਜਾਣ ਲਈ ਉਹ ਆਪਣਾ ਸਮਾਨ ਅਤੇ ਮੇਰਾ ਸਮਾਨ ਬਹੁਤ ਚੰਗੀ ਤਰ੍ਹਾਂ ਸਾਂਭ ਕੇ ਰੱਖਦਾ ਹੈ ਆਪਣੇ ਹਰੇਕ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਵੇਖਦਾ ਪਰਖਦਾ ਹੈ ਆਪਣੀ ਟਰਿਪ ਨੂੰ ਯਾਦਗਾਰ ਬਣਾਉਣ ਲਈ ਉਹ ਇੱਕ ਨੋਟਸ ਬਣਾਉਂਦਾ ਹੈ ਅਤੇ ਹਰੇਕ ਦ੍ਰਿਸ਼ ਨੂੰ ਆਪਣੀ ਕਾਪੀ ਉੱਪਰ ਲਿਖਦਾ ਰਹਿੰਦਾ ਹੈ ਦਿਲਪ੍ਰੀਤ ਜਦੋਂ ਵੀ ਜਾਂ ਮੇਰੇ ਨਾਲ ਟਰਿਪ 'ਤੇ ਗਿਆ ਉਸਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਨਾਲ ਮੇਰੇ ਸਮਾਨ ਦਾ ਵੀ ਧਿਆਨ ਰੱਖਿਆ ਅਤੇ ਮੈਨੂੰ ਵੱਖ ਵੱਖ ਦ੍ਰਿਸ਼ਾਂ ਤੋਂ ਜਾਣੂ ਕਰਵਾਇਆ